ਹੈਲੋ ਹਾਂਜੀ ਮੈਂ ਬੁਕਿੰਗ ਤੋਂ ਬੋਲ ਰਹੀ ਹਾਂ ਮਤਲਬ ਕਿੰਨੇ ਕੁ ਦਿਨਾਂ ਤੱਕ ਤੁਹਾਨੂੰ ਕਿੰਨੇ ਕੁ ਦਿਨਾਂ ਬਾਅਦ ਦੀ ਟਿਕਟ ਚਾਹੀਦੀ ਆ ਇੱਕ ਹਫਤੇ ਤੱਕ ਤਾਂ ਮੁਸ਼ਕਲ ਹੈ ਕਿਉਂਕਿ ਛੁੱਟੀਆਂ ਦਾ ਟਾਈਮ ਚੱਲ ਰਿਹਾ ਅਤੇ ਸੀਟਾਂ ਜਿਹੜੀਆਂ ਹੈਗੀਆਂ ਨੇ ਪਹਿਲੇ ਸਾਰੀਆਂ ਬੁੱਕ ਹੋ ਚੁੱਕੀਆਂ ਨੇ ਹਾਂਜੀ ਜੋ ਵੀ ਤੁਸੀਂ ਜੋ ਵੀ ਤੁਸੀਂ ਬੁਕਿੰਗ ਕਰਵਾਈ ਹੈ ਉਹਦਾ ਅਸੀਂ ਦਸ ਪਰਸੈਂਟ ਤਾਂ ਕੱਟਾਂਗੇ ਪਹਿਲੇ ਹਾਂਜੀ ਅਤੇ ਹਫਤੇ ਨਹੀਂ ਦਸ ਜਾਂ ਬਾਰ੍ਹਾਂ ਦਿਨਾਂ ਤੱਕ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਦਸ ਬਾਰ੍ਹਾਂ ਦਿਨਾਂ ਬਾਅਦ ਜ ਮਤਲਬ ਸੀਟ ਮਿਲ ਜਾਵੇ ਹਾਂਜੀ ਅਤੇ ਨਹੀਂ ਨਹੀਂ ਫਿਰ ਜ਼ਿਆਦਾ ਕੱਟਿਆ ਜਾਵੇਗਾ ਫਿਰ ਵੀਹ ਪਰਸੈਂਟ ਕੱਟਾਂਗੇ ਜੇਕਰ ਤੁਸੀਂ ਕੈਂਸਲ ਕਰਵਾਉਂਦੇ ਹੋ ਟਿਕਟ ਤਾਂ

ਹਾਂਜੀ ਹਾਂਜੀ ਪਤਾ ਕੀ ਹੈ ਕਿਉਂਕਿ ਛੁੱਟੀਆਂ ਹੈਗੀਆਂ ਨੇ ਸਾਰਿਆਂ ਨੂੰ ਹੀ ਛੁੱਟੀਆਂ ਦੇ ਦਿਨ ਹੈਗੇ ਨੇ ਹਾਂਜੀ ਜਿਹਦੇ ਕਰਕੇ ਪਹਿਲੇ ਸਾਰੀਆਂ ਸੀਟਾਂ ਬੁੱਕ ਹੋ ਚੁੱਕੀਆਂ ਨੇ ਅਸੀਂ ਫਿਰ ਨਹੀਂ ਨਹੀਂ ਹਾਂਜੀ ਇੰਨੀ ਜਲਦੀ ਨਹੀਂ ਹੋ ਸਕੇਗਾ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਸ ਬਾਰ੍ਹਾਂ ਦਿਨਾਂ ਤੱਕ ਦੀ ਟਿਕਟ ਮਿਲਜੇ ਹਾਂਜੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਹੋਰ ਵੀ ਮਤਲਬ ਇਸ ਤੋਂ ਅੱਗੇ ਦੀ ਨਾ ਮਿਲੇ ਇੰਨੇ ਤੱਕ ਹੀ ਮਿਲਜੇ ਵੈਸੇ ਤਾਂ ਪਹਿਲੇ ਸਾਰੀਆਂ ਸੀਟਾਂ ਬੁੱਕ ਹੋ ਚੁੱਕੀਆਂ ਨੇ ਦਸ ਬਾਰ੍ਹਾਂ ਦਿਨਾਂ ਤੱਕ ਵੀ ਹਾਂਜੀ ਜਾਂ ਤਾਂ ਤੁਸੀਂ ਜਿਵੇਂ ਪਹਿਲੇ ਕੋਈ ਕੁਛ ਕਹਿੰਦੇ ਤਾਂ ਫਿਰ ਤਾਂ ਹੋ ਸਕਦਾ ਸੀ ਹਾਂਜੀ ਹਾਂਜੀ

ਹਾਂਜੀ ਜਿਹੜੀ ਵੀ ਤੁਸੀਂ ਬੁਕਿੰਗ ਕਰਵਾਈ ਉਹਦੇ ਵਿੱਚ ਅਸੀਂ ਦਸ ਪਰਸੈਂਟ ਕੱਟਾਂਗੇ ਅਤੇ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਬਸ ਆਹ ਦਸ ਬਾਰ੍ਹਾਂ ਦਿਨਾਂ ਤੱਕ ਟਿਕਟ ਮਿਲਜੇ ਹਾਂਜੀ ਥੈਂਕ ਕੋਈ ਨਾ ਕੋਈ ਨਾ